ਹੈਲੋ ਮਿਸ਼ੋ ਸਰਵਿਸ ਸੈਂਟਰ ਮੈਂ ਬਲਜੀਤ ਕੌਰ ਮੈਂ ਹਰ ਵਾਰ ਮਿਸ਼ੋ ਐਪ ਤੋਂ ਕੁਝ ਨਾ ਕੁਝ ਮੰਗਵਾਉਂਦੀ ਰਹਿੰਦੀ ਹਾਂ ਮੈਂ ਇਸ ਵਾਰ ਮਿਸ਼ੋ ਤੋਂ ਬੂਟ ਮੰਗਵਾਏ ਸੀ ਉਹ ਬੂਟ ਬਹੁਤ ਹੀ ਘਟੀਆ ਕੁਆਲਿਟੀ ਦੇ ਆਏ ਨੇ ਜਿਸ ਦਿਨ ਮੈਨੂੰ ਬੂਟ ਚਾਹੀਦੇ ਸੀ ਉਸ ਤੋਂ ਦੋ ਤਿੰਨ ਦਿਨ ਬਾਅਦ ਮੈਨੂੰ ਆਰਡਰ ਮਿਲਿਆ ਪਹਿਲੀ ਗੱਲ ਤਾਂ ਸ਼ੂਜ਼ ਦੀ ਪੈਕਿੰਗ ਹੀ ਬਹੁਤ ਘਟੀਆ ਸੀ ਅਤੇ ਮੈਨੂੰ ਜਿਹੜੇ ਕਲਰ ਦੇ ਬੂਟ ਮੈਂ ਮੰਗਵਾਏ ਸੀਗੇ ਉਹ ਕਲਰ ਤਾਂ ਮੈਨੂੰ ਬੂਟਾਂ ਦਾ ਮਿਲਿਆ ਹੀ ਨਹੀਂ ਉਹਦਾ ਸਾਈਜ਼ ਵੀ ਬਹੁਤ ਛੋਟਾ ਸੀ ਜਿਹਦੇ ਕਰਕੇ ਮੈਨੂੰ ਉਹ ਸ਼ੂਜ਼ ਸੀ ਜਿਹੜੇ ਉਹ ਮੈਨੂੰ ਮੇਰੀ ਛੋਟੀ ਭੈਣ ਨੂੰ ਦੇਣੇ ਪਏ ਅਤੇ ਉਹਦੇ ਪਾਉਣ ਤੋਂ ਵੀ ਥੋੜ੍ਹੇ ਦਿਨਾਂ ਬਾਅਦ ਹੀ ਉਹ ਟੁੱਟਣੇ ਸਟਾਰਟ ਹੋ ਗਏ ਅਤੇ ਜਿਹੜੇ ਡੱਬੇ ਵਿੱਚ ਉਹ ਬੂਟ ਆਏ ਸੀ ਉਹ ਡੱਬਾ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਜਿਵੇਂ ਕਿਸੇ ਚੀਜ਼ ਦਾ ਉਹ 'ਤੇ ਵਜ਼ਨ ਆ ਗਿਆ ਹੋਵੇ ਇਹ ਬੂਟ ਮੈਨੂੰ ਬਿਲਕੁਲ ਪਸੰਦ ਨਹੀਂ ਆਏ ਹੈਗੇ ਗੇ ਮੈਨੂੰ ਹਰ ਵਾਰ ਬਹੁਤ ਵਧੀਆ ਪ੍ਰੋਡਕਟ ਮਿਲਦਾ ਹੈਗਾ ਪਰ ਇਸ ਵਾਰ ਵਾਲਾ ਪ੍ਰੋਡਕਟ ਬਹੁਤ ਘਟੀਆ ਕੁਆਲਿਟੀ ਦਾ ਆਇਆ ਸੀ ਇਸ ਲਈ ਜਾਂ ਤਾਂ ਮੈਨੂੰ ਨਵੇਂ ਬੂਟ ਦਿਓ ਜਾਂ ਫਿਰ ਮੈਨੂੰ ਪੈ ਮੇਰੇ ਪੈਸੇ ਰਿਟਰਨ ਕਰੋ ਧੰਨਵਾਦ